ਸਾਡੇ ਰੂਪਨਗਰ ਜ਼ਿਲ੍ਹਾ ਜੋ ਕਿ ਬਹੁਤ ਹਰਿਆ ਭਰਿਆ ਹੈ ਜਿਸ ਵਿੱਚ ਮੁੱਖ਼ ਕੁਦ ਕੁਦਰਤੀ ਸਰੋਤ ਸਾਡੇ ਸਤਲੁਜ ਦਰਿਆ ਜੋ ਕਿ ਦੋ ਭਾਗਾਂ ਵਿੱਚ ਵੰਡ ਹੋ ਜਾਂਦਾ ਹੈ ਔਰ ਬੀ ਬੀ ਐੱਮ ਬੀ ਭਾਖੜਾ ਨਹਿਰ ਤੋਂ ਇੱਕ ਨਹਿਰ ਪੱਕੀ ਵੀ ਸਾਡੇ ਸ਼ਹਿਰ ਰੂਪਨਗਰ ਜ਼ਿਲ੍ਹੇ ਵਿੱਚ ਆਉਂਦੀ ਹੈ ਜਿਸ ਨਾਲ ਸਾਡੇ ਪਾਣੀ ਦੀ ਕੋਈ ਕਮੀ ਨਹੀਂ ਹੈ ਔਰ ਬਹੁਤ ਵਧੀਆ ਹ ਹਰਿਆ ਭਰਿਆ ਸਾਡਾ ਸ਼ਹਿਰ ਹੈ ਔਰ ਸਾਫ਼ ਸਫ਼ਾਈ ਵਾਲੇ ਪੱਖੋਂ ਅਗਰ ਦੇਖਿਆ ਜਾਵੇ ਤਾਂ ਸਾਡੇ ਰੂਪਨਗਰ ਦੀ ਨਗਰਪਾਲਿਕਾ ਸਾਡੇ ਸ਼ਹਿਰ ਦਾ ਬਹੁਤ ਖਿਆਲ ਰੱਖਦੀ ਹੈ ਅਤੇ ਲਗਾਤਾਰ ਸਫ਼ਾਈ ਕਰਦੀ ਰਹਿੰਦੀ ਹੈ ਜਿਸ ਨਾਲ ਕਿ ਸਾਡੇ ਸ਼ਹਿਰ ਵਿੱਚ ਕੋਈ ਕੂੜੇ ਅਤੇ ਗੰਦਗੀ ਦੇ ਢੇਰ ਨਹੀਂ ਲੱਗਦੇ ਔਰ ਸਾਡਾ ਬਹੁਤ ਹੀ ਵਧੀਆ ਸਾਫ਼ ਸੁ ਸੁਥਰਾ ਅਤੇ ਹਰਿਆ ਭਰਿਆ ਸ਼ਹਿਰ ਹੈ